ਮੈਂ ਆਪਣੇ ਮੋਬਾਈਲ ਵਿੱਚ ਜਾ ਕੇ ਫਲਿੱਪਕਾਰਟ ਐਪ ਖੋਡੀ ਖੋਲ੍ਹੀ ਜਿਸ ਵਿੱਚ ਮੈਂ ਆਪਣੇ ਮਨਪਸੰਦੀਦਾ ਚੀਜ਼ਾਂ ਆਰਡਰ ਲਈ ਕਾਰਟ ਵਿੱਚ ਰੱਖੀਆਂ ਹੋਈਆਂ ਸੀਗੀਆਂ ਪਰ ਜਦੋਂ ਮੈਂ ਉਹਨਾਂ ਦੀ ਸਟਾਰ ਰੇਟਿੰਗ ਗਿਰਦੀ ਹੋਈ ਦੇਖੀ ਤਾਂ ਮੈਨੂੰ ਇਹ ਲੱਗਿਆ ਕਿ ਮੈਂ ਉਹ ਚੀਜ਼ ਖਰੀਦ ਕੇ ਆਪਣੇ ਪੈਸੇ ਖਰਾਬ ਕਰਨਾ ਚਾਹਵਾਂਗਾ ਜਿਸ ਦੌਰਾਨ ਤਾਂ ਮੈਂ ਹਰ ਇੱਕ ਚੀਜ਼ ਪਹਿਲਾਂ ਚੈੱਕ ਕੀਤੀ ਕਿ ਉਹ ਜੇ ਅਗਰ ਮੇਰੀ ਜ਼ਰੂਰਤਮੰਦ ਨਹੀਂ ਹੈ ਤਾਂ ਮੈਂ ਉਹਨੂੰ ਕਾਰਟ ਵਿੱਚੋਂ ਹਟਾਉਂਦਾ ਗਿਆ ਜਿਵੇਂ ਕਿ ਮੈਂ ਜੁੱਤੇ ਪਸੰਦ ਕੀਤੇ ਸੀ ਸਪੋਰਟਸ ਦੇ ਉਹ ਮੈਂ ਜਿੰਮ ਜਾਣ ਲਈ ਪਸੰਦ ਕੀਤੇ ਸੀ ਬਟ ਜਦ ਮੈਂ ਦੇਖਿਆ ਰਿਵਿਊਜ਼ ਦੇਖੇ ਉਹਦੇ ਉਸ 'ਤੇ ਲਿਖਿਆ ਆਉਂਦਾ ਸੀ ਕਿ ਇਹ ਦਸ ਦਿਨਾਂ ਬਾਅਦ ਹੀ ਫਟਣ ਲੱਗ ਗਏ ਹਨ ਜੋ ਕਿ ਮੇਰੇ ਅਕੋਡਿੰਗ ਇਹ ਹੈ ਕਿ ਮ ਮੇਰੀ ਵਰਤੋਂ ਵਿੱਚ ਆ ਹੀ ਨਹੀਂ ਸਕਦੇ ਮੈਂ ਸੋਚਿਆ ਸੀ ਕਿ ਜੇਕਰ ਮੈਂ ਜੁੱਤੇ ਲਵਾਂਗਾ ਘੱਟੋ ਘੱਟ ਦੋ ਸਾਲ ਚਲਾਵਾਂਗਾ ਤਾਂ ਇਸ ਕਰਕੇ ਮੈਂ ਉਹ ਜੁੱਤੇ ਵੀ ਹਟਾ ਦਿੱਤੇ ਹਨ ਤਾਂ ਫਿਰ ਅੱਗੇ ਜਾ ਕੇ ਮੈਂ ਇੱਕ ਆਪਣੇ ਮੋਬਾਈਲ ਦਾ ਕਵਰ ਵੀ ਰੱਖਿਆ ਹੋਇਆ ਸੀ ਜੋ ਮੈਂ ਆਪਣੇ ਕਾਰਟ 'ਚ ਰੱਖਿਆ ਹੋਇਆ ਸੀ ਜੋ ਮੈਨੂੰ ਬਹੁਤ ਪਸੰਦ ਸੀ ਮਗਰ ਜਦ ਮੈਂ ਉਹਦੀ ਵੀ ਰੇਟਿੰਗ ਦੇਖੀ ਉਹਦਾ ਵੀ ਦੋ ਦਸ ਦਿਨਾਂ ਬਾਅਦ ਹੀ ਉਹਦਾ ਰੰਗ ਮਿਟਣ ਲੱਗ ਗਿਆ ਸੀ ਜਿਸ ਕਰਕੇ ਮੈਂ ਉਹ ਵੀ ਹਟਾ ਦਿੱਤੀ ਗਈ ਮਗਰ ਉਸ ਤੋਂ ਬਾਅਦ ਮੈਂ ਇੱਕ ਹੋਰ ਕਾਰਟ ਵਿੱਚ ਦੇਖੀ ਕਿ ਉਹਦੀ ਰੇਟਿੰਗਸ ਵੱਧ ਹੀ ਰਹੀ ਸੀ ਤਾਂ ਮੈਂ ਉਹ ਚੀਜ਼ ਰੱਖੀ ਅਤੇ ਮੈਂ ਉਹ ਖਰੀਦ ਲਈ ਹੈ ਬਾਕੀ ਸਾਰੀਆਂ ਮੈਂ ਚੀਜ਼ਾਂ ਹਟਾ ਦਿੱਤੀਆਂ ਸੀ